ਸਤਿ ਸ਼੍ਰੀ ਅਕਾਲ ਸਰ ਸਰ ਮੈਂ ਕਾਰਤਿਕ ਬੋਲ ਰਿਹਾ ਪਠਾਨਕੋਟ ਤੋਂ ਸਰ ਮੈਂ ਤੁਹਾਡੇ ਐਪ ਤੋਂ ਇੱਕ ਪੱਖਾ ਔਡਰ ਕੀਤਾ ਸੀ ਬਹੁਤ ਹੀ ਵਧੀਆ ਕੰਪਨੀ ਦਾ ਔਰ ਬਹੁਤ ਹੀ ਵਧੀਆ ਕੁਆਲਿਟੀ ਦਾ ਸਰ ਹੈਵਲ ਕੰਪਨੀ ਦਾ ਪੱਖਾ ਸੀਗਾ ਸਰ ਮੈਨੂੰ ਬਹੁਤ ਹੀ ਪਸੰਦ ਆਇਆ ਮੈਂ ਜਦੋਂ ਤੁਹਾਡੀ ਸਾਈਟ 'ਤੇ ਪੱਖੇ ਨੂੰ ਦੇਖਿਆ ਸੀ ਸਰ ਉਹਦੀ ਡਿਜਾਇਨਿੰਗ ਵੀ ਬਹੁਤ ਅੱਛੀ ਸੀ ਔਰ ਉਸਦੀ ਕੁਆਲਿਟੀ ਬਹੁਤ ਅੱਛੀ ਅੱਛੀ ਸ਼ੋ ਕੀਤੀ ਜਾ ਰਹੀ ਸੀ ਬਟ ਸਰ ਉਸ ਦੀ ਮੈਨੂੰ ਸਰ ਡਿਲੀਵਰੀ ਡੇਟ ਚਾਰ ਤਰੀਕ ਦੱਸੀ ਗਈ ਸੀ ਕਿ ਤੁਹਾਡਾ ਪੱਖਾ ਚਾਰ ਤਰੀਕ ਨੂੰ ਤੁਹਾਨੂੰ ਮਿਲ ਜਾਵੇਗਾ ਪਰ ਸਰ ਉਹ ਚਾਰ ਤੱਕ ਨਹੀਂ ਆਇਆ ਸਰ ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਹੋਇਆ ਬਹੁਤ ਨਿਰਾਸ਼ਾ ਹੋਈ ਸੀ ਕਿ ਪੱਖਾ ਦੋ ਦਿਨ ਲੇਟ ਹੋ ਗਿਆ ਬਟ ਉਸਦਾ ਕੋਈ ਚੱਕਰ ਨਹੀਂ ਪਰ ਤਾਂ ਵੀ ਸਰ ਜਦੋਂ ਮੈਂ ਉਸ ਉਹਦੀ ਪੈਕਿੰਗ ਨੂੰ ਓਪਨ ਕੀਤਾ ਤਾਂ ਸਰ ਪੱਖਾ ਪੱਖੇ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਸਰ ਬਟ ਪੱਖੇ ਦੀ ਸਰ ਮੋਟਰ ਸੜ ਗਈ ਸੀ ਇਸ ਕਰਕੇ ਸਰ ਮੈਨੂੰ ਥੋੜ੍ਹਾ ਹੋਰ ਫੀਲ ਹੋਇਆ ਕਿ ਨਹੀਂ ਇਸ ਕਰਕੇ ਉਸ ਦਿਨ ਸਰ ਫਿਰ ਮੈਂ ਘਰ ਇਲੈਕਟਰੀਸ਼ਨ ਵਾਲੇ ਨੂੰ ਸੱਦਿਆ ਤਾਂ ਇਲੈਕਟਰੀਸ਼ਨ ਵਾਲੇ ਨੂੰ ਦੱਸਿਆ ਪੱਖੇ ਨੂੰ ਇੱਦਾਂ ਇੱਦਾਂ ਹੋਇਆ ਤਾਂ ਬੋਲਦਾ ਕਿ ਪੱਖੇ ਦੀ ਮੋਟਰ ਸ਼ੁਰੂ ਤੋਂ ਸੜੀ ਹੋਈ ਸੀ ਇਸ ਕਰਕੇ ਸਰ ਉਹਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਬਟ ਠੀਕ ਨਹੀਂ ਹੋਇਆ ਤਾਂ ਕਰਕੇ ਸਰ ਉਸ ਉਸ ਪੱਖੇ ਨੂੰ ਫਿਰ ਵਾਪਿਸ ਕੀਤਾ ਜਾਵੇ ਜਾਂ ਮੇਰੇ ਪੈਸੇ ਵਾਪਿਸ ਕੀਤੇ ਜਾਣ ਇਸ ਕਰਕੇ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਅਗਰ ਇਹ ਤੁਸੀਂ ਮੇਰੀ ਹੈਲਪ ਨਹੀਂ ਕੀਤੀ ਤਾਂ ਮੈਂ ਤੁਹਾਡੇ ਉੱਤੇ ਕਾਰਵਾਈ ਵੀ ਕਰ ਸਕਦਾ ਹਾਂ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਧੰਨਵਾਦ